ਹੈਲੋ ਨਮਸ਼ਕਾਰ ਸਰ ਸਰ ਮੈਂ ਚੰਦਨ ਕਾਲੜਾ ਬੋਲ ਰਿਆ ਜੀ ਸਰ ਮੈਂ ਫਾਜ਼ਿਲਕਾ ਤੋਂ ਗੱਲ ਕਰ ਰਿਆ ਸਰ ਮੇਰੇ ਖਿਆਲ ਜੋਬ ਪਲੇਸਮੈਂਟ ਦਾ ਕੰਮ ਕਰਦੇ ਓ ਹੈਨਾ ਤੁਸੀਂ ਸਰ ਏਦਾਂ ਐ ਕੀ ਐਕਚੁਲੀ ਮੈਂ ਨਾ ਬੀ ਏ ਕੰਪਲੀਟ ਕੀਤੀ ਐ ਆਪਦੀ ਹਲੇ ਮਹੀਨਾ ਹਲੇ ਪੰਦਰਾਂ ਵੀਹ ਦਿਨ ਈ ਹੋਏ ਐ ਜੇ ਐਗਜੈਕਟਲੀ ਦੇਖਣ ਤਾਂ ਹਾਂਜੀ ਤਾਂ ਅੱਗੇ ਜਿਹੜੀ ਓਪਰਚੂਨੀਟੀਸ ਹੈਗੀਆਂ ਜੋਬ ਦੀਆਂ ਉਨ ਦੇ ਬਾਰੇ ਪੁੱਛਣਾ ਸੀ ਤੁਹਾਨੂੰ ਹਾਂਜੀ ਮੈਂ ਕੰਪਿਊਟਰ ਕੋਰਸ ਕੀਤਾ ਹੋਇਆ ਸਰ ਕਿਸ ਤਰ੍ਹਾਂ ਦੀ ਮਤਲਬ ਕਿਸੇ ਪ੍ਰਾਈਵੇਟ ਕੰਪਨੀ 'ਚ ਹੋ ਸਕਦੀ

ਸੈੱਲਰ ਵਿੱਚ ਹਾਂਜੀ ਇਹ ਵੀ ਓਪ੍ਰਚੂਨੀਟੀ ਚੰਗੀ ਐ ਤੇ ਜੇ ਕੋਈ ਹੋਰ ਮੈਨੂੰ ਸਰ ਬੈਂਕ ਸਹੀ ਰਹੇਗਾ ਸਰ ਹਾਂਜੀ ਠੀਕ ਐ ਮੇਰੇ ਮਾਕਸ ਸਹੀ ਐ ਮੈਂ ਸੈਵਨਟੀ ਪਰਸੈਂਟ ਮਾਕਸ ਲਿੱਤੇ ਐ ਠੀਕ ਐ ਠੀਕ ਐ ਸਰ

ਠੀਕ ਐ ਸਰ ਤੁਹਾਡਾ ਓਫਿਸ ਕਿੱਥੇ ਕ ਐ ਸਰ ਕਿਸ ਨਾਮ 'ਤੇ ਓਫਿਸ ਐ ਠੀਕ ਐ ਸਰ ਠੀਕ ਐ ਠੀਕ ਐ ਠੀਕ ਐ ਠੀਕ ਐ ਮੈਂ ਕੱਲ ਸਵੇਰੇ ਈ ਥੋਨੂੰ ਮਿਲ ਲੈਨਾ ਠੀਕ ਐ ਸਰ ਠੀਕ ਐ ਥੈਂਕਿਊ